ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਇੱਥੇ ਦੇ ਸੱਭਿਆਚਾਰ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਵੈਸੇ ਤਾਂ ਇਸ ਇੱਥੇ ਕਿੱਤਾ ਟਰਾਂਸਪੋਰਟੇਸ਼ਨ ਵੀ ਹੈ ਪਰ ਜ਼ਿਆਦਾਤਰ ਲੋਕ ਖੇਤੀ 'ਤੇ ਨਿਰਭਰ ਹਨ ਅੱਜ ਕੱਲ੍ਹ ਇੱਥੋਂ ਦੇ ਲੋਕ ਖੇਤੀ ਤੋਂ ਬਾਹਰ ਚਲੇ ਗਏ ਹਨ ਇਹਦਾ ਬਹੁਤ ਸਾਰੇ ਕਾਰਨ ਹਨ ਸਭ ਤੋਂ ਪਹਿਲਾ ਕਾਰਨ ਹੈ ਕਿ ਖੇਤੀ ਅੱਜ ਕੱਲ੍ਹ ਖੇਤੀ ਘੱ ਜ਼ਮੀਨਾਂ ਕਿਸਾਨਾਂ ਕੋਲ ਘੱਟ ਹਨ ਅਤੇ ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਮਸ਼ੀਨੀ ਯੁੱਗ ਆਉਣ ਕਰਕੇ ਖੇਤੀ ਕਰਨ ਲਈ ਟਰੈਕਟਰ ਹੋਰ ਮਸ਼ੀਨਾਂ ਬਹੁਤ ਸਾਰੀਆਂ ਮਸ਼ੀਨਾਂ ਚਾਹੀਦੀਆਂ ਜਿਨ੍ਹਾਂ ਦੇ ਖਰਚੇ ਬਹੁਤ ਜ਼ਿਆਦਾ ਹਨ ਉੱਤੋਂ ਪੈਟਰੋਲ ਡੀਜ਼ਲ ਦਾ ਖਰਚਾ ਬਹੁਤ ਵੱਧ ਗਿਆ ਹੈ ਨਾਲ ਹੀ ਨਾਲ ਸਾਧਨ ਦੇ ਘੱਟ ਹੋਣ ਦੇ ਨਾਲ ਨਾਲ ਹੋਰ ਸੁਵਿਧਾ ਵੀ ਘੱਟ ਹਨ ਜਿਵੇਂ ਕਿ ਸ਼ਹਿਰ ਤੋਂ ਦੂਰ ਖੇਤੀ ਕਰਨ ਲਈ ਖਰਚੇ ਵੱਧ ਜਾਂਦੇ ਹਨ ਫੇਰ ਅੱਜ ਕੱਲ੍ਹ ਰਹਿਣ ਸਹਿਣ ਸਹਿਣ ਦੇ ਢੰਗ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਕੋਲਜ ਚਾਹੀਦੇ ਹਨ ਜਿਸ ਕਰਕੇ ਉਹ ਖੇਤੀ ਛੱਡ ਕੇ ਕਿਸਾਨ ਸ਼ਹਿਰਾਂ ਕੰਨੀ ਨੂੰ ਚਲੇ ਗਏ ਹਨ ਜਿੱਥੇ ਕਿ ਬਹੁਤ ਜ਼ਿਆਦਾ ਸੁਵਿਧਾ ਮਿਲ ਜਾਂਦੀ ਹੈ ਅਤੇ ਪਿੰਡਾਂ 'ਚ ਹੋਰ ਖੇਤੀ ਦੇ ਖਰਚੇ ਕਰਕੇ ਉਹਨਾਂ ਨੂੰ ਲੋਨ ਲੈਣਾ ਪੈਂਦਾ ਹੈ ਲੋਨ ਦੀਆਂ ਕਿਸ਼ਤਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ ਅਤੇ ਫੇਰ ਕਈ ਕਈ ਕਾਰਨ ਕਈ ਕਾਰਨ ਇਹ ਵੀ ਹੈ ਕਿ ਕੀਟਨਾਸ਼ਕ ਦਵਾਈਆਂ ਖੇਤੀ 'ਤੇ ਪਾਉਣ ਲਈ ਚਾਹੀਦੀਆਂ ਹਨ ਉਹ ਵੀ ਸ਼ਹਿਰਾਂ ਤੋਂ ਮਿਲਦੀਆਂ ਹਨ ਅਤੇ ਇਹਨਾਂ ਨਾਲ ਖੇਤੀ ਪੀ ਖਰਚਾ ਲਾਗਤ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਲੋਕ ਇਸ ਤੋਂ ਬਦਲ ਕੇ ਕਿੱਤਾ ਹੋਰ ਪਾਸੇ ਦੂਸਰੇ ਕਿੱਤੇ ਕਰਨ ਲੱਗ ਗਏ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਘੱਟ ਮਿਹਨਤ ਨਾਲ ਜ਼ਿਆਦਾ ਇਨਕਮ ਹੋ ਸਕੇ